ਮੈਂ ਆਪਣੀ ਸਕੂਲੀ ਪੜ੍ਹਾਈ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜੀ ਟੀ ਰੋਡ ਅੰਮ੍ਰਿਤਸਰ ਤੋਂ ਕੀਤੀ ਹੈ ਫਿਰ ਪਲੱਸ ਟੂ ਕਰਨ ਤੋਂ ਬਾਅਦ ਮੈਂ ਆਪਣੀ ਇੰਜੀਨੀਰਿੰਗ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਬੇਅੰਤ ਕੋਲਜ ਔਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਗੁਰਦਾਸਪੁਰ ਤੋਂ ਕੀਤੀ ਹੈ ਫਿਰ ਉਸ ਤੋਂ ਮੈਂ ਥੋੜ੍ਹੀ ਦੇਰ ਲਈ ਵਿਪਰੋ ਜੀ ਈ ਦੇ ਵਿੱਚ ਐਜ ਏ ਸਰਵਿਸ ਇੰਜੀਨੀਅਰ ਕੰਮ ਕੀਤਾ ਚੰਡੀਗੜ੍ਹ ਦੇ ਵਿੱਚ ਫਿਰ ਉਸ ਤੋਂ ਬਾਅਦ